ਮੇਰਾ ਸਭ ਤੋਂ ਚੁਣੌਤੀਪੂਰਨ ਰੂਟ ਜਦੋਂ ਮੈਂ ਆਪਣੇ ਨਾਨਕੇ ਪਿੰਡ ਪੜ੍ਹਨ ਲਈ ਲੱਗਾ ਤਾਂ ਅਸੀਂ ਮੁੰਡੇ ਰਲ ਕੇ ਸਕੂਲ ਪੜ੍ਹਨ ਲਈ ਜਾਂਦੇ ਸਨ ਨਾਲ ਦੇ ਪਿੰਡ ਵਿੱਚ ਸਕੂਲ ਸੀ ਅਤੇ ਨਾਲ ਦੇ ਪਿੰਡ ਦਾ ਜਿਹੜਾ ਰਸਤਾ ਸੀ ਉਹ ਕੱਚਾ ਸੀ ਜਦੋਂ ਸਾਰੇ ਇਕੱਠੇ ਹੋ ਕੇ ਜਾਂਦੇ ਤਾਂ ਸਾਨੂੰ ਚਲਦੇ ਚਲਦੇ ਪੈਦਲ ਸਕੂਲ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਸੀ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਫਿਰ ਇੱਕ ਵਾਰ ਮੇਰੇ ਨਾਨਾ ਜੀ ਨੇ ਮੈਨੂੰ ਨਵਾਂ ਸਾਈਕਲ ਲੈ ਕੇ ਦਿੱਤਾ ਮੈਂ ਆਪਣੇ ਸਾਈਕਲ 'ਤੇ ਸਕੂਲ ਪੜ੍ਹਨ ਲਈ ਜਾਂਦਾ ਸੀ ਸਕੂਲ ਪੜ੍ਹਨ ਲਈ ਜਦੋਂ ਜਾਂਦਾ ਸੀ ਤਾਂ ਰਸਤਾ ਕੱਚਾ ਸੀ ਤਾਂ ਕਾਫੀ ਰੇਤਾ ਹੁੰਦਾ ਸੀ ਤਾਂ ਖੱਡੇ ਬਣ ਜਾਂਦੇ ਸੀਗੇ ਤਾਂ ਉਹ ਖੱਡਿਆਂ ਦੇ ਵਿੱਚ ਸਾਈਕਲ ਵੱਜ ਜਾਂਦਾ ਸੀਗਾ ਤਿਲਕ ਜਾਂਦਾ ਸੀ ਫਿਸਲ ਜਾਂਦਾ ਸੀ

ਆਪਣੇ ਸਕੂਲ ਹੌਲੀ ਹੌਲੀ ਸਾਈਕਲ ਨੂੰ ਲੈ ਕੇ ਪਹੁੰਚ ਜਾਂਦਾ ਸੀ ਇੱਕ ਵਾਰ ਕੀ ਹੋਇਆ ਕਿ ਮੈਂ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਬੈਗ ਮੇਰਾ ਪਿੱਛੇ ਸੀ ਸਾਈਕਲ 'ਤੇ ਕਾਫੀ ਵੱਡਾ ਖੱਡਾ ਬਣ ਗਿਆ ਕੱਚੇ ਰਸਤੇ ਵਿੱਚ ਜਦੋਂ ਮੈਂ ਖੱਡੇ ਦੀ ਸਾਈਡ ਤੋਂ ਸਾਈਕਲ ਲੰਘਾਉਣ ਲੱਗਿਆ ਤਾਂ ਮੇਰਾ ਸਾਈਕਲ ਫਿਸਲ ਗਿਆ ਅਤੇ ਮੈਂ ਉਹ ਖੱਡੇ ਵਿੱਚ ਜਾ ਡਿੱਗਿਆ ਜਿਸ ਕਾਰਨ ਮੇਰੇ ਗੋਡੇ 'ਤੇ ਸੱਟ ਲੱਗ ਗਈ ਸੀ ਅਤੇ ਸਾਈਕਲ ਦੀਆਂ ਕੁਝ ਤਾਰਾਂ ਟੁੱਟ ਗਈਆਂ ਅਤੇ ਥੋੜ੍ਹਾ ਚੱਕੇ ਵਿੱਚ ਵਲ਼ ਪੈ ਗਿਆ ਸੀ ਮੈਂ ਉੱਠ ਕੇ ਹੌਲੀ ਹੌਲੀ ਆਪਣੇ ਸਾਈਕਲ ਨੂੰ ਲੈ ਕੇ ਲੰਗੜਾਉਂਦਾ ਹੋਇਆ ਹੌਲੀ ਹੌਲੀ ਕਾਫੀ ਦੇਰ ਤੱਕ ਮੈਂ ਸਕੂਲ ਪਹੁੰਚਿਆ ਸਕੂਲ ਵਿੱਚ ਅੱਗੇ ਮਾਸਟਰ ਜੀ ਸੀ ਉਹਨਾਂ ਨੇ ਮੈਨੂੰ ਪੁੱਛਿਆ ਉਹਨਾਂ ਨੂੰ ਮੈਂ ਆਪਣੀ ਸਾਰੀ ਘਟਨਾ ਬਾਰੇ ਦੱਸਿਆ ਤਾਂ ਸਰ ਨੇ ਪੱਟੀ ਕਰਵਾ ਕੇ ਮੈਨੂੰ ਕਿਹਾ ਕਿ ਤੈਨੂੰ ਛੁੱਟੀ ਦੇ ਦਿੰਦਾ ਹਾਂ ਅਤੇ ਤੂੰ ਆਪਣੇ ਘਰ ਚਲਾ ਜਾ ਤੇਰੇ ਸੱਟ ਲੱਗ ਚੁੱਕੀ ਹੈ ਸਰ ਨੇ ਮੈਨੂੰ ਛੁੱਟੀ ਦੇ ਦਿੱਤੀ ਮੈਂ ਹੌਲੀ ਹੌਲੀ ਆਪਣੇ ਸਾਈਕਲ ਨੂੰ ਲੈ ਕੇ ਪੈਦਲ ਤੁਰ ਕੇ ਆਪਣੇ ਹੌਲੀ ਹੌਲੀ ਆਪਣੇ ਘਰ ਪਹੁੰਚਿਆ ਘਰ ਪਹੁੰਚਣ ਵਿੱਚ ਮੈਨੂੰ ਬੜੀ ਹੀ ਰਸਤੇ ਵਿੱਚ ਮੁਸ਼ਕਿਲ ਆਈ ਕਿਉਂਕਿ ਮੇਰੀ ਲੱਤ 'ਚ ਦਰਦ ਹੋ ਰਿਹਾ ਸੀ ਸਾਈਕਲ ਦਾ ਚੱਕਾ ਵਿੰਗਾ ਸੀ ਉਹ ਮੇਰੇ ਤੋਂ ਚੱਲ ਨਹੀਂ ਰਿਹਾ ਸੀ ਬੈਗ ਮੇਰਾ ਕਾਫੀ ਭਾਰਾ ਸੀ ਜਿਸ ਕਾਰਨ ਪੜ੍ਹਦੇ ਸਮੇਂ ਮੈਨੂੰ ਸਭ ਤੋਂ ਚੁਣੌਤੀਪੂਰਨ ਰੂਟ ਮੇਰਾ ਇਹੀ ਸੀ ਕਿ ਜਦੋਂ ਮੈਂ ਪੜ੍ਹਦਾ ਸੀ ਤਾਂ ਉਹ ਰਸਤਾ ਕੱਚਾ ਸੀਗਾ ਅਤੇ ਸਾਈਕਲ ਚੱਲਦਾ ਨਹੀਂ ਸੀ ਪੈਦਲ ਤੁਰ ਕੇ ਜਾਈਦਾ ਨਹੀਂ ਸੀ ਕਿਉਂਕਿ ਗਰਮੀਆਂ ਵਿੱਚ ਰੇਤ ਗਰਮ ਹੋ ਜਾਂਦਾ ਸੀ ਗਰਮੀ ਜ਼ਿਆਦਾ ਹੁੰਦੀ ਸੀ ਇੰਨਾਂ ਸਫਰ ਕਰਕੇ ਸਕੂਲ ਪਹੁੰਚਿਆ ਨਹੀਂ ਜਾਂਦਾ ਸੀ ਸਾਈਕਲ 'ਤੇ ਜਾਂਦਿਆਂ ਮੇਰਾ ਸਭ ਤੋਂ ਚੁਣੌਤੀਪੂਰਨ ਰੂਟ ਮੇਰੀ ਪੜ੍ਹਾਈ ਦਾ ਸੀ ਅਤੇ ਮੈਂ ਬਹੁਤ ਹੀ ਮੁਸ਼ਕਿਲ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਇਸ ਪੜ੍ਹਈ ਨੂੰ ਪੂਰਾ ਕੀਤਾ